ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਮੇਰੀ ਗੱਲ ਸਵਿਗੀ ਵਾਲਿਆਂ ਨਾਲ ਹੋ ਰਹੀ ਆ ਭਾਅ ਜੀ ਮੈਂ ਨਾ ਕੁਛ ਸਮਾਨ ਔਡਰ ਕੀਤਾ ਸੀ ਹਾਂਜੀ ਹਾਂ ਵਿੱਚ ਦਾਲ ਦਾਲ ਮੱਖਣੀ ਸੀਗੀ ਹਾਂਜੀ ਥੋੜ੍ਹੇ ਚੋਲ ਸੀਗੇ ਅਤੇ ਸ਼ਾਹੀ ਪਨੀਰ ਸੀਗਾ ਅਤੇ ਨਾਨ ਸੀਗੇ ਹਾਂ ਹਾਂਜੀ ਭਾਅ ਜੀ ਇੰਨਾਂ ਲੇਟ ਕਿਉਂ ਥੋੜ੍ਹਾ ਜਲਦੀ ਦੇ ਦਿਓ ਐਕਚੁਲੀ ਕੀ ਆ ਭੁੱਖ ਬਹੁਤ ਜਲਦੀ ਲੱਗੀ ਆ ਮੈਂ ਮੰਨਦੀ ਹਾਂ ਟ੍ਰੈਫਿਕ ਹੈਗਾ ਆ ਪਰ ਮੈਂ ਕੀ ਕਰ ਸਕਦੀ ਹਾਂ ਮੈਨੂੰ ਥੋੜ੍ਹਾ ਮੇਰੇ ਗੈਸਟ ਵੀ ਆਏ ਹੋਏ ਆ ਅਤੇ ਥੋੜ੍ਹਾ ਜਲਦੀ ਕਰ ਦਿਓ ਹਾਂਜੀ ਭਾਅ ਜੀ ਓਕੇ ਓਕੇ ਥੋੜ੍ਹਾ ਜਲਦੀ ਇੰਨਾਂ ਡਿਲੇ ਨਾ ਕਰੋ ਨਾ ਓਕੇ